ਸਾਡੇ ਸਾਡੇ ਪੰਜਾਬ ਵਿੱਚ ਮੱਝਾਂ ਅਤੇ ਗਾਈਆਂ ਦੁੱਧ ਦੇਣ ਲਈ ਬਹੁਤ ਮਸ਼ਹੂਰ ਹਨ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਇਹ ਦੁੱਧ ਪਿਓਰ ਨਹੀਂ ਮਿਲਦਾ ਦੁੱਧ ਮੱਝਾਂ ਦਾ ਦੁੱਧ ਜੋ ਕਿ ਚਾਹ ਦੇ ਵਿੱਚ ਪਾਉਣ ਦੇ ਕੰਮ ਆਉਂਦਾ ਨਾ ਆਉਂਦਾ ਹੈ ਇਸ ਸਭ ਬੱਚੇ ਰਾਤ ਨੂੰ ਦੁੱਧ ਪੀਂਦੇ ਨੇ ਅਤੇ ਗਾਈਆਂ ਦਾ ਦੁੱਧ ਜਿਹੜਾ ਹੁੰਦਾ ਉਹ ਪਤਲਾ ਗਿਣਿਆ ਜਾਂਦਾ ਜੋ ਕਿ ਛੋਟੇ ਬੱਚਿਆਂ ਨੂੰ ਦੇਣ ਨੂੰ ਕੰਮ ਆਉਂਦਾ ਹੈ ਛੋਟੇ ਬੱਚੇ ਗਾਂ ਦਾ ਦੁੱਧ ਪੀ ਕੇ ਤਾਕਤਵਾਰ ਬਣਦੇ ਹਨ ਅਗਰ ਗਾਂ ਦਾ ਦੁੱਧ ਪੀਂਦੇ ਆ ਤਾਂ ਬੱਚੇ ਨੂੰ ਤਾਂ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ ਮੱਝ ਮੱਝਾਂ ਦਾ ਦੁੱਧ ਜੋ ਕਿ ਗਾੜ੍ਹਾ ਗਿਣਿਆ ਜਾਂਦਾ ਹੈ ਉਸ ਦਾ ਦੁੱਧ ਖੋਇਆ ਅਤੇ ਮਠਿਆਈਆਂ ਦੁੱਧ ਤੋਂ ਬਣਦੀਆਂ ਨੇ ਦੁੱਧ ਤੋਂ ਪਨੀਰ ਬਣਦਾ ਹੈ ਪਨੀਰ ਬਣਦਾ ਦਹੀਂ ਬਣਦਾ ਜੋ ਕਿ ਸਾਡੇ ਬਹੁਤ ਵਰਤੋਂ ਦੇ ਵਿੱਚ ਆਉਂਦਾ ਹੈ ਮੱਝ ਦਾ ਦੁੱਧ ਦੁੱਧ ਦੇ ਉੱਤੋਂ ਘੀ ਬਣਦਾ ਆ ਘੀ ਵੀ ਬਹੁਤ ਵਧੀਆ ਪਿਓਰ ਬਣਦਾ ਅਤੇ ਗਾਂ ਦੇ ਦੁੱਧ ਦਾ ਘੀ ਬਣਦਾ ਜੋ ਕਿ ਉਹ ਘਿਓ ਬਹੁਤ ਵਧੀਆ ਹੁੰਦਾ ਹੈ ਗਾਂ ਦਾ ਦੁੱਧ ਗਾਂ ਦਾ ਦੁੱਧ ਜਿਹੜੇ ਬੱਚੇ ਪੀਂਦੇ ਨੇ ਉਹ ਬਹੁਤ ਤਕੜੇ ਹੁੰਦੇ ਨੇ